ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਗੁਰੂ ਨਾਨਕ ਦੇਵ ਜੀ ਦਾ ਜਨਮ ਚੌਂਦਾਂ ਸੌ ਉਣਹੱਤਰ ਈਸਵੀ ਵਿੱਚ ਹੋਇਆ ਸੀ ਅਤੇ ਇਹ ਸਿੱਖ ਧਰਮ ਦੇ ਸੰਸਥਾਪਕ ਅਤੇ ਦਸਾਂ ਗੁਰੂਆਂ ਦੇ ਮੋਢੀ ਵੀ ਆਖੇ ਜਾਂਦੇ ਹਨ ਉਹ ਸਮੁੱਚੇ ਪੰਜਾਬ ਅਤੇ ਭਾਰਤ ਦੇ ਅਧਿਆਤਮਕ ਅਤੇ ਸਮਾਜਿਕ ਇਤਿਹਾਸ ਵਿੱਚ ਇੱਕ ਕੇਂਦਰੀ ਹਸਤੀ ਹਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਇੱਕ ਏਕਾਅਦਿਕ ਵਿਸ਼ਵਾਸ ਜੋ ਸਮਾਨਤਾ ਸਮਾਜਿਕ ਨਿਆਂ ਅਤੇ ਇੱਕ ਪਰਮਾਤਮਾ ਪ੍ਰਤੀ ਸ਼ਰਧਾ 'ਤੇ ਜ਼ੋਰ ਦਿੰਦਾ ਹੈ ਉਹ ਉਸ ਦੇ ਫਲਸਫੇ ਨੇ ਪੰਜਾਬ ਦੇ ਧਾਰਮਿਕ ਅਤੇ ਸਮਾਜਿਕ ਦ੍ਰਿਸ਼ਾਂ ਨੂੰ ਡੂੰਘਾ ਰੂਪ ਵਿੱਚ ਸੁਧਾਰ ਕਰਨ ਦਾ ਯੋਗਦਾਨ ਵੀ ਦਿੱਤਾ ਹੈ ਲਿੰਗ ਅਤੇ ਧਾਰਮਿਕ ਵਿਸ਼ੇਸ਼ਤਾ ਦੇ ਮੌਜੂਦਾ ਨਿਯਮਾਂ ਨੂੰ ਚੁਣੌਤੀ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਦੇ ਪਹਿਲੂ ਅਤੇ ਉਹਨਾਂ ਦੀ ਆਪਾਂ ਹੁਣ ਜੀਵਨ ਦੀ ਸ਼ੁਰੂਆਤੀ ਅਤੇ ਪਿਛੋਕੜ ਬਾਰੇ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਚੌਂਦਾਂ ਸੌ ਉਣਹੱਤਰ ਵਿੱਚ ਪਿੰਡ ਤਲਵੰਡੀ ਜੋ ਕਿ ਹੁਣ ਪਾਕਿਸਤਾਨ ਵਿੱਚ ਨਨਕਾਨਾ ਸਾਹਿਬ ਵਿੱਚ ਸਥਿਤ ਹੈ ਵਿੱਚ ਖੱਤਰੀ ਜਾਤੀ ਦੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਨੇ ਛੋਟੀ ਉਮਰ ਤੋਂ ਹੀ ਉਹਨਾਂ ਨੇ ਅਧਿਆਤਮਿਕ ਅਤੇ ਦਿਲਚਸਪੀ ਦਿਖਾਈ ਸੀ ਅਕਸਰ ਧਾਰਮਿਕ ਵਿਦਵਾਨਾਂ ਨਾਲ ਦਾਰਸ਼ਨਿਕ ਚਰਚਾਵਾਂ ਵਿੱਚ ਸ਼ਾਮਿਲ ਹੁੰਦੇ ਸਨ ਉਹਨਾਂ ਨੇ ਤੀਹ ਸਾਲ ਦੀ ਉਮਰ ਵਿੱਚ ਇੱਕ ਅਧਿਆਤਮਿਕ ਅਨੁਭਵ ਦੌਰਾਨ ਕਥਿਤ ਤੌਰ 'ਤੇ ਤਿੰਨ ਦਿਨਾਂ ਲਈ ਅਲੋਪ ਹੋ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇੱਕ ਡੂੰਘੇ ਅਨੁਭਵ ਨਾਲ ਉਭਰਿਆ ਇਸ ਗਿਆਨ ਤੋਂ ਬਾਅਦ ਉਸ ਦੇ ਪਹਿਲੇ ਸ਼ਬਦ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਇਹ ਹੀ ਸਨ ਇਹ ਘੋਸ਼ਣਾ ਵਿੱਚ ਮਨੁੱਖਤਾ ਦੀ ਏਕਤਾ ਵੱਲ ਜੋਰ ਦਿੱਤਾ ਗਿਆ ਅਤੇ ਧਾਰਮਿਕ ਵੰਡਾਂ ਨੂੰ ਵੀ ਰੱਦ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਸਿੱਖਿਆਵਾਂ ਵੀ ਦਿੱਤੀਆਂ ਜਿਵੇਂ ਧਰਮ ਕਿਰਤ ਕਰੋ ਵੰਡ ਛਕੋ ਅਤੇ ਉਨ੍ਹਾਂ ਨੇ ਆਪਣੇ ਏ ਪੂਰੇ ਜੀਵਨ ਕਾਲ ਦੇ ਸਮੇਂ ਚਾਰ ਉਦਾਸੀਆਂ ਵੀ ਕੀਤੀਆਂ ਉਨ੍ਹਾਂ ਨੇ ਸਾਰੀ ਜਗ੍ਹਾ 'ਤੇ ਇਹ ਇੱਕ ਉਪਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ ਅਤੇ ਆਪਣੇ ਆਪ ਨੂੰ ਕਿਸੇ ਵੀ ਮੂਰਤੀ ਪੂਜਨ ਲਈ ਨਹੀਂ ਕਿਹਾ ਉਹ ਸਿਰਫ਼ ਅਪ ਪਰਮਾਤਮਾ ਨੂੰ ਮਨ ਵਿੱਚ ਧਿਆਉਣ ਲਈ ਹੀ ਉਪਦੇਸ਼ ਦਿਆ ਕਰਦੇ ਸਨ ਗੁਰੂ ਨਾਨਕ ਦੇਵ ਜੀ ਸਭ ਤੋਂ ਸਿੱਖਾਂ ਦੇ ਪਹਿਲੇ ਮੋਢੀ ਸਨ ਅਤੇ ਇਹ ਸਭ ਉਹਨਾਂ ਬਾਰੇ ਜਾਣਕਾਰੀਆਂ ਸਨ ਉਹਨਾਂ ਨੇ ਬਹੁਤ ਹੀ ਯੋਗਦਾਨ ਦਿੱਤਾ ਹੈ ਅਤੇ ਉਹ ਸਭ ਤੋਂ ਹੀ ਵੱਡੇ ਪਹਿਲੇ ਗੁਰੂ ਜੀ ਆਖੇ ਜਾਂਦੇ ਸਨ ਧੰਨਵਾਦ